ਵਧੀਆ ਜੀ ਤੁਸੀਂ ਦੱਸੋ ਕੀ ਕਰਦੇ ਤੁਸੀਂ ਬਸ ਘਰ ਹੀ ਰਹੀ ਦਾ ਤੁਸੀਂ ਦੱਸੋ ਕੀ ਕਰਦੇ ਪਏ ਹੋ ਅੱਛਾ ਕਿਉਂ ਇੱਥੇ ਭੀੜ ਵੀ ਬਹੁਤ ਹੁੰਦੀ ਹੈ ਨਾ ਫਿਰ ਅਤੇ ਕਮਰਾ ਲੈਣਾ ਪਏਗਾ ਉੱਥੇ ਅੱਛਾ ਅੱਛਾ ਫਿਰ ਜਦੋਂ ਆਪਾਂ ਕੰਮ 'ਤੇ ਜਾਣਾ ਫਿਰ ਲੇਟ ਨਾ ਹੋ ਜਾਇਆ ਕਰਾਂਗੇ ਵਹੀਕਲ ਨਾ ਮਿਲਿਆ ਤਾਂ ਅੱਛਾ ਵਹੀਕਲ ਚੱਲਣ ਨੂੰ ਟਾਈਮ ਹੁੰਦੇ ਹੈ ਆਪਾਂ ਨੂੰ ਪਤਾ ਨਹੀਂ ਕਿਹੜਾ ਟਾਈਮ ਹੈ ਅੱਛਾ ਹੋਰ ਸ਼ਹਿਰ 'ਚ ਕੀ ਹੋ ਸਕਦਾ ਜੇ ਆਪਾਂ ਲਈਏ ਆਪਾਂ ਨੂੰ ਕੀ ਫਾਇਦੇ ਹੈ ਉਹਦੇ

ਅੱਛਾ ਅੱਛਾ ਅਤੇ ਖਾਣ ਪੀਣ ਨੂੰ ਮਿਲ ਜਾਏਗਾ ਖਾਣ ਪੀਣ ਨੂੰ ਮਿਲ ਜਾਏਗਾ ਸਸਤਾ ਮਿਲੇਗਾ ਕੇ ਮਹਿੰਗਾ ਸ਼ਹਿਰਾਂ 'ਚ ਕਰਾਏ ਬਹੁਤ ਜ਼ਿਆਦਾ ਹੁੰਦੇ ਹੈ ਕਮਰਿਆਂ ਦੇ ਆਪਾਂ ਕਿਵੇਂ ਲਵਾਂਗੇ ਅਤੇ ਨਾਲ ਨੌਕਰੀ ਵੀ ਕਰਨੀ ਪਏਗੀ ਥੋੜ੍ਹੀ ਜਿਹੀ ਹਾਂਜੀ ਹਾਂ ਫਿਰ ਦੇਖ ਲਓ ਪੱਕਾ ਲੈਣਾ ਸ਼ਹਿਰ 'ਚ ਕਿ ਕਿਤੇ ਹੋਰ ਵੇਖ ਲਈਏ ਕਿਸੇ ਹੋਰ ਸ਼ਹਿਰ 'ਚ ਅੱਛਾ ਸਾਰੀ ਸਹੂਲਤ ਹੋਵੇ ਤਾਂ ਹੀ ਫਾਇਦਾ ਹੈ ਨਾ ਐਵੇਂ ਲੈ ਲਈਏ ਫਿਰ ਆਪਾਂ

ਸ਼ਹਿਰਾਂ 'ਚ ਨਾ ਇੱਕ ਤਾਂ ਸ਼ੋਰ ਬਹੁਤ ਹੁੰਦਾ ਹੈ ਅਤੇ ਵਹੀਕਲ ਬਹੁਤ ਚਲਦੇ ਹੈ ਪੜ੍ਹਿਆ ਨਹੀਂ ਜਾਣਾ ਆਪਣੇ ਕੋਲੋਂ ਅੱਛਾ ਟਿਊਸ਼ਨ ਟੀਚਰ ਮਿਲ ਜਾਣਗੇ ਅੱਛਾ ਅੱਛਾ ਸਾਰਾ ਪਤਾ ਕਰ ਕੇ ਫਿਰ ਲਵਾਂਗੇ ਐਵੇਂ ਤਾਂ ਨਹੀਂ ਲਿਆ ਜਾਣਾ ਅਤੇ ਬਸ ਠੀਕ ਹੈ ਬਸ ਫਿਰ ਨਹੀਂ ਪਹੁੰਚਾ ਦਏਗੀ ਛੇਤੀ ਲੇਟ ਨਾ ਹੋ ਜਾਈਏ ਅੱਛਾ ਕੋਲਜ ਪਹੁੰਚ ਜਾਂਦੇ ਟਾਈਮ ਨਾਲ ਠੀਕ ਹੈ ਠੀਕ ਓਕੇ ਓਕੇ